ਜਿਵੇਂ ਕਿ ਅਸੀਂ ਦੇਖ ਰਹੇ ਹਾਂ ਆਪਣੇ ਭਾਰਤ ਵਿੱਚ ਬੇਰੁਜ਼ਗਾਰੀ ਬਹੁਤ ਜਿਆਦਾ ਵੱਧ ਰਹੀ ਹੈ ਇੰਨੇ ਬੱਚੇ ਪੜ੍ਹ ਲਿਖ ਕੇ ਫਿਰ ਵੀ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਹਨ ਆਪਾਂ ਬਾਹਰ ਦੀਆਂ ਚੀਜ਼ਾਂ ਨੂੰ ਪਹਿਲਾਂ ਜਿਆਦਾ ਪ੍ਰਮੋਟ ਕਰਦੇ ਹਾਂ ਆਪਣੇ ਹੀ ਇੰਡੀਅਨ ਚੀਜ਼ਾਂ ਨੂੰ ਜਿਹੜਾ ਕਿ ਪ੍ਰਮੋਟ ਕਰਨਾ ਚਾਹੀਦਾ ਹੈ ਇੱਥੇ ਬੱਚੇ ਨੇ ਇਹ ਬਹੁਤ ਜਿਆਦਾ ਪੜ ਲਿਖ ਕੇ ਬੇਰੁਜ਼ਗਾਰ ਹੋ ਰਹੇ ਹਨ ਇਹ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕੀ ਵੱਧ ਤੋਂ ਵੱਧ ਇੱਥੇ ਉਦਯੋਗ ਜਾਂ ਕੋਈ ਫੈਕਟਰੀਆ ਵਗੈਰਾ ਲਗਾਉਣ ਜਿਸ ਕਰਕੇ ਬੇਰੋਜ਼ਗਾਰੀ ਘੱਟ ਸਕੇ ਤੇ ਕਈ ਬੱਚੇ ਤਾਂ ਪੜ੍ਹ ਵੀ ਨਹੀਂ ਸਕਦੇ ਇਹਨ ਸਕੂਲਾਂ ਤੇ ਕਾਲਜਾਂ ਦੀਆਂ ਫੀਸਾਂ ਇੰਨੀਆਂ ਇੰਨੀਆਂ ਪੈਸੇ ਹੁੰਦੇ ਹਨ ਬੱਚੇ ਜਿਆਦਾ ਪੜ ਵੀ ਨਹੀਂ ਸਕਦੇ ਗਰੀਬ ਬੱਚੇ ਜੋ ਕੀ ਪੜ੍ਹਾਈ ਦੀ ਮੁਫਤ ਕੀਤੀ ਜਾਵੇ ਜਾਂ ਉਹ ਘੱਟ ਤੋਂ ਘੱਟ ਪੈਸੇ ਲੈ ਕੇ ਪੜ੍ਹਾਈ ਕੀਤੀ ਜਾਵੇ ਬੱਚਿਆਂ ਕਰਕੇ ਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕੀ ਇਹ ਨੌਜਵਾਨਾਂ ਵਾਸਤੇ ਨੌਕਰੀਆਂ ਵੱਧ ਤੋਂ ਵੱਧ ਕੱਢੀਆਂ ਜਾਣ ਜਿਸ ਤਰ੍ਹਾਂ ਜਿਵੇਂ ਬੈਂਕ 'ਚ ਦਸ ਮੁਲਾਜ਼ਮਾਂ ਨੂੰ ਦਸ ਦੀ ਜਗ੍ਹਾ ਬਾਰਾ ਉਹ ਕੰਮ ਵੀ ਜਿਆਦਾ ਹੋਊਗਾ ਤੇ ਬੱਚਿਆਂ ਨੂੰ ਬੇਰੁਜ਼ਗਾਰ ਰੁਜ਼ਗਾਰ ਵੀ ਮਿਲਣਾ ਸ਼ੁਰੂ ਹੋ ਜਾਏਗਾ ਆਪਣੇ ਭਾਰਤ ਵਿੱਚ ਵੱਧ ਤੋਂ ਵੱਧ ਫੈਕਟਰੀਆਂ ਵਗੈਰਾ ਲਗਾਉਣ ਇਸ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ